ਮੇਰਾ ਮਨਪਸੰਦ ਲੇਖਕ ਹੈ ਮੇਰੇ ਮਨਪਸੰਦ ਲੇਖਕ ਵਿੱਚੋਂ ਡਾਕਟਰ ਸੁਰਜੀਤ ਪਾਤਰ ਮੇਰਾ ਮਨਪਸੰਦ ਲੇਖਕ ਸੁਰਜੀਤ ਪਾਤਰ ਆਧੁਨਿਕ ਪੰਜਾਬੀ ਕਵਿਤਾ ਦਾ ਇੱਕ ਬਹੁਤ ਵੱਡਾ ਨਾਮ ਹੈ ਇੱਕ ਬਹੁਤ ਵੱਡੇ ਸ਼ਾਇਰ ਨੇ ਪੰਜਾਬੀ ਦੇ ਜਿਨ੍ਹਾਂ ਦੀਆਂ ਕਿਤਾਬਾਂ ਦੇ ਵਿੱਚੋਂ ਹਨੇਰੇ 'ਚੋਂ ਸੁਲਗਦੀ ਵਰਣਮਾਲਾ ਹਵਾ 'ਚ ਲਿਖੇ ਹਰਫ ਇੱਕ ਉਹਨਾਂ ਦੀ ਹੋਰ ਕਿਤਾਬ ਸੂਰਜ ਮੰਦਰ ਦੀਆਂ ਪੌੜੀਆਂ ਤਾਂ ਇਹਨਾਂ ਦੀਆਂ ਜਿਹੜੀਆਂ ਮਹੱਤਵਪੂਰਨ ਕਿਤਾਬਾਂ ਰਹੀਆਂ ਨੇ ਪੰਜਾਬੀ ਸਾਹਿਤ ਦੇ ਵਿੱਚ ਹਾਂ ਔਰ ਉਹਨਾਂ ਦੀ ਲਿਖਤ ਪਸੰਦ ਹੈ ਇੱਕ ਤਾਂ ਕਿਉਂਕਿ ਉਹਨਾਂ ਨੇ ਲੰਬਾ ਸਮਾਂ ਜਿਹੜੀ ਪੰਜਾਬ ਨਾਲ ਸੰਬੰਧਿਤ ਪੰਜਾਬੀ ਭਾਸ਼ਾ ਨਾਲ ਸੰਬੰਧਿਤ ਜਿਹੜੀ ਸ਼ਾਇਰੀ ਕੀਤੀ ਹੈ ਕਵਿਤਾਵਾਂ ਲਿਖੀਆਂ ਨੇ ਤਾਂ ਉਹਨਾਂ ਕਵਿਤਾਵਾਂ ਦੇ ਜਿਹੜੇ ਵਿਸ਼ੇ ਨੇ ਉਹ ਬਹੁਤ ਸੰਜੀਦਾ ਵਿਸ਼ੇ ਨੇ ਪੰਜਾਬ ਦੀਆਂ ਵੱਖ ਵੱਖ ਸਮੱਸਿਆਵਾਂ ਨਾਲ ਸੰਬੰਧਿਤ ਨੇ ਜਿਹੜੀਆਂ ਕਿ ਸੁਲਝਣੀਆਂ ਚਾਹੀਦੀਆਂ ਨੇ ਉਹ ਭਾਵੇਂ ਪੰਜਾਬੀ ਭਾਸ਼ਾ ਦਾ ਭਾਵੇਂ ਪੰਜਾਬ ਦੀ ਸਥਿਤੀ ਦਾ ਉਹਨਾਂ ਨੇ ਜਿੰਨਾ ਟਾਈਮ ਸ਼ਾਇਰੀ ਕੀਤੀ ਉਹਨਾਂ ਨੇ ਵੱਖ ਵੱਖ ਪੰਜਾਬ ਦੀਆਂ ਸਥਿਤੀਆਂ ਬਾਰੇ ਸਮੇਂ ਸਮੇਂ ਜਿਹੜੇ ਉਹ ਲਿਖਦੇ ਰਹੇ ਆ ਤਾਂ ਇੱਕ ਵਿਅਕਤੀ ਵਿਅਕਤੀ ਵਜੋਂ ਵੀ ਜਿਹੜੇ ਉਹ ਇੱਕ ਬਹੁਤ ਨਿਮਰ ਇਨਸਾਨ ਨੇ ਬਹੁਤ ਨਿਮਰ ਵਿਅਕਤੀ ਨੇ ਬਹੁਤ ਹਲੀਮੀ ਦੇ ਉਹਨਾਂ ਦੇ ਵਿੱਚ ਤਾਂ ਇਸ ਤਰ੍ਹਾਂ ਉਹ ਜਿਹੜਾ ਵਿਅਕਤੀ ਵਿਸ਼ੇਸ਼ ਵਜੋਂ ਵੀ ਮਨਪਸੰਦ ਨੇ